ਹਾਂ ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਅਤੇ ਮੌਕੇ ਨਹੀਂ ਦਿੱਤੇ ਜਾਂਦੇ ਹਨ ਕਿਉਂਕਿ ਮੈਂ ਵੀ ਇਕ ਕਲਾਕਾਰ ਹੁੰਦਾ ਸੀ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਸੀ ਜਦੋਂ ਮੈਂ ਇੱਕ ਬਾਰਵੀਂ ਕਲਾਸ ਵਿੱਚ ਸੀ ਤਾਂ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਸੀ ਤਾਂ ਮੈਂ ਉਸ ਪੇਂਟਿੰਗ ਵਿੱਚ ਬਹੁਤ ਪ੍ਰਾਈਜ਼ਿਜ਼ ਵਗੈਰਾ ਜਿੱਤੇ ਬਹੁਤ ਕੋਂਪੀਟੀਸ਼ਨ ਵਗੈਰਾ ਲੜੇ ਮਾਰਕੀਟ ਵਿੱਚ ਬਹੁਤ ਕੋਂਪੀਟੀਸ਼ਨ ਬਟ ਤਾਂ ਵੀ ਮੈਂ ਅੱਗੇ ਵਧਿਆ ਬਟ ਮੇਰੇ ਮੰਮੀ ਪਾਪਾ ਨੇ ਬਹੁਤ ਜ਼ੋਰ ਦਿੱਤਾ ਪੇਂਟਿੰਗ ਵਿੱਚ ਕੁਛ ਨਹੀਂ ਰੱਖਿਆ ਕੀ ਕਾਏਂ ਕਮਾਏਗਾ ਕੀ ਖਾਏਗਾ ਕਿੱਦਾਂ ਆਪਣੀ ਲਾਈਫ ਕੱਟੇਗਾ ਕੁਛ ਨਹੀਂ ਰੱਖਿਆ ਤੂੰ ਗੌਰਮੈਂਟ ਜੋਬ ਵੱਲ ਜਾ ਗੌਰਮੈਂਟ ਜੋਬ ਕਰ ਗੌਰਮੈਂਟ ਜੋਬ ਦੀ ਤਿਆਰੀ ਕਰ ਬਟ ਮੈਂ ਵੀ ਥੋੜ੍ਹਾ ਬਹੁਤਾ ਲੜਿਆ ਬਟ ਹਾਰ ਕੇ ਮੈਨੂੰ ਘਰ ਦਿਆਂ ਦੀ ਗੱਲ ਮੰਨਣੀ ਪਈ ਜਿਥੋਂ ਤੱਕ ਮੈਨੂੰ ਇੱਕ ਗੱਲ ਯਾਦ ਹੈ ਕਿ ਮੇਰਾ ਇੱਕ ਦੋਸਤ ਸੀ ਉਹ ਉਹਨੂੰ ਨਾ ਗਾਣਿਆਂ ਦਾ ਬਹੁਤ ਸ਼ੌਕ ਸੀ ਉਹ ਗਾਣੇ ਬਹੁਤ ਵਧੀਆ ਗਾਉਂਦਾ ਸੀ ਉਹਦਾ ਯੂਟੀਊਬ ਚੈਨਲ ਵੀ ਸੀ ਅਤੇ ਯੂਟੀਊਬ ਚੈਨਲ ਵੀ ਚੱਲ ਰਿਹਾ ਸੀ ਉਹਦੇ ਘਰਦਿਆਂ ਨੇ ਵੀ ਬਹੁਤ ਉਹਨੂੰ ਸਪੋਰਟ ਕੀਤਾ ਬਟ ਤੁਹਾਨੂੰ ਜਿਵੇਂ ਪਤਾ ਹੀ ਆ ਅੱਜ ਦੇ ਟਾਈਮ 'ਤੇ ਸਿਫਾਰਸ਼ੀ ਕੰਮ ਬਹੁਤ ਚੱਲ ਰਿਹਾ ਸਿਫਾਰਸ਼ ਕਿਸੇ ਦਾ ਤਾਇਆ ਲੱਗਿਆ ਹੁੰਦਾ ਕਿਸੇ ਦਾ ਚਾਚਾ ਲੱਗਿਆ ਹੁੰਦਾ ਕਿਸੇ ਦਾ ਮਾਮਾ ਲੱਗਿਆ ਹੁੰਦਾ ਕਿਸੇ ਦਾ ਪਾਪਾ ਲੱਗਿਆ ਹੁੰਦਾ ਅਤੇ ਸਿਫਾਰਸ਼ ਕਰਕੇ ਉਹ ਪਿੱਛੇ ਰਹਿ ਗਿਆ ਉਹਦੇ ਕੋਈ ਸਿਫਾਰਸ਼ ਨਹੀਂ ਸੀ ਅਤੇ ਲੋਕ ਅੱਜ ਦੇ ਟਾਈਮ 'ਤੇ ਪੈਸੇ ਵੀ ਬਹੁਤ ਮੰਗ ਰਹੇ ਸੀ ਸਿਫਾਰਸ਼ ਦੇ ਨਾਲ ਅਤੇ ਪੈਸੇ ਵੀ ਬਹੁਤ ਮੰਗ ਰਹੇ ਸੀ ਤਾਂ ਉਹ ਕਰਕੇ ਉਹ ਪਿੱਛੇ ਰਹਿ ਗਿਆ ਅਤੇ ਜਿਹਨੂੰ ਲੋੜ ਕਲਾਕਾਰ ਬਣਨਾ ਚਾਹੀਦਾ ਉਹ ਕਲਾਕਾਰ ਨਹੀਂ ਬਣਦਾ ਜਿਹਨੂੰ ਨਹੀਂ ਬਣਨਾ ਚਾਹੀਦਾ ਉਹ ਕਲਾਕਾਰ ਬਣ ਜਾਂਦਾ ਹੈ ਤਾਂ ਕਰਕੇ ਭਾਰਤ ਆਪਣਾ ਇੱਕ ਕਲਾਕਾਰ ਖੋ ਲੈਂਦਾ ਹੈ